ਤੁਸੀਂ ਕਪੂਰਥਲਾ ਕੈਬਸ ਸਰਵਿਸ ਤੋਂ ਗੱਲ ਕਰ ਰਹੇ ਹੋ ਮੈਂ ਨਾ ਤੁਹਾਡੀ ਐਪ ਤੋਂ ਇੱਕ ਘੰਟੇ ਪਹਿਲਾਂ ਕੈਬ ਬੁੱਕ ਕੀਤੀ ਸੀਗੀ ਅਤੇ ਮੈਂ ਕਿਤੇ ਜਾਣਾ ਸੀਗਾ ਉਹ ਇਦ ਮੇਰੇ ਘਰ ਤੋਂ ਘੱਟ ਤੋਂ ਘੱਟ ਦੋ ਤਿੰਨ ਘੰਟੇ ਦੂਰ ਆ ਅਤੇ ਮੈਂ ਉੱਥੇ ਜਾਣ ਵਾਸਤੇ ਕੈਬ ਬੁੱਕ ਕੀਤੀ ਸੀ ਪਰ ਹਜੇ ਤੱਕ ਕੈਬ ਨਹੀਂ ਆਈ ਤੁਸੀਂ ਆਪਣੀ ਐਪ 'ਤੇ ਲਿਖਿਆ ਸੀਗਾ ਕਿ ਤੁਸੀਂ ਪੰਦਰਾਂ ਮਿੰਟ ਤੱਕ ਮੇਰੇ ਘਰ ਤੱਕ ਪਹੁੰਚ ਜਾਉਂਗੇ ਬਟ ਪਤਾ ਨਹੀਂ ਟੈਕਨੀਕਲ ਇਸ਼ੂ ਦੇ ਕਾਰਨ ਹਜੇ ਤੱਕ ਕੋਈ ਉੱਥੇ ਚੇਂਜਿਸ ਨਹੀਂ ਆ ਰਹੇ ਤਾਂ ਮੈਂ ਜਾਣਨਾ ਚਾਹੁੰਦੀ ਸੀ ਕਿ ਮੇਰੇ ਕੈਬ ਲੇਟ ਹੋਣ ਦਾ ਰੀਜਨ ਕੀ ਆ ਮੈਂ ਕਿਤੇ ਛੇਤੀ ਜਾਣਾ ਸੀਗਾ ਅਤੇ ਹੁਣ ਤੁਸੀਂ ਕਿਰਪਾ ਕਰਕੇ ਤੁਰੰਤ ਮੈਨੂੰ ਕੋਈ ਕੈਬ ਬੁੱਕ ਕਰਕੇ ਦੇ ਦਿਓ ਤਾਂ ਜੋ ਮੈਂ ਟਾਈਮ ਸਿਰ ਉੱਥੇ ਪਹੁੰਚ ਸਕਾਂ ਧੰਨਵਾਦ